ਖੇਡਾਂ ਲੋਕਾਂ ਲਈ ਸਟਰੈਸ ਰਹਿਤ ਅਤੇ ਆਨੰਦਿਤ ਆਊਟਲੇਟ ਹੈ ਜਿਵੇਂ ਮੈਂ ਆਪਣੇ ਅਨੁਭਵ ਤੋਂ ਦੱਸ ਸਕਦਾ ਹਾਂ ਕਿ ਮੈਂ ਕੋਲਜ 'ਚ ਆ ਕੇ ਪੜ੍ਹਾਈ ਵੱਲ ਥੋੜ੍ਹਾ ਵੱਧ ਧਿਆਨ ਪਾ ਦਿੱਤਾ ਅਤੇ ਆਪਣੀ ਕਸਰਤ ਅਤੇ ਖੇਡਾਂ ਵੱਲ ਘੱਟ ਧਿਆਨ ਰੱਖਿਆ ਜਿਸ ਕਰਕੇ ਇਸ ਦਾ ਪ੍ਰਭਾਵ ਮੇਰੀ ਸਿਹਤ 'ਤੇ ਕਾਫੀ ਪਿਆ ਹੈ ਮੈਨੂੰ ਸਰਵਾਈਕਲ ਅਤੇ ਥੋੜ੍ਹਾ ਵਜ਼ਨ ਗ ਵੱਧ ਗਿਆ ਅਤੇ ਹੁਣ ਮੈਂ ਥੋੜ੍ਹਾ ਧਿਆਨ ਖੇਡਾਂ ਵੱਲ ਰੱਖਿਆ ਹੈ ਕਿਉਂਕਿ ਕੁਝ ਦਿਨ ਪਹਿਲਾਂ ਮੈਂ ਆਪਣਾ ਐਨ ਐਸ ਐਸ ਦਾ ਕੈਂਪ ਲਾ ਕੇ ਆਇਆ ਸੀ ਜਿਸ ਵਿੱਚ ਕਾਫੀ ਕਸਰਤ ਖੇਡਾਂ ਅਤੇ ਸੈਰ ਮੈਂ ਕੀਤੀ ਜਿਸ ਨਾਲ ਮੇਰੇ ਸਰੀਰ ਨੂੰ ਕਾਫੀ ਵਧੀਆ ਲੱਗਾ ਮੇਰੀ ਸਾਰੀ ਸੁਸਤੀ ਉੱਡ ਗਈ ਅਤੇ ਮੈਂ ਆਪਣਾ ਵਧੀਆ ਤੋਂ ਵਧੀਆ ਧਿਆਨ ਪਾ ਪਾਇਆ ਇਸ ਨਾਲ ਮੇਰਾ ਪੜ੍ਹਾਈ 'ਤੇ ਵੀ ਕਾਫੀ ਵਧੀਆ ਪ੍ਰਭਾਵ ਪਿਆ ਅਤੇ ਮੈਂ ਵਧੀਆ ਪੜ੍ਹ ਸਕਿਆ ਕਿਉਂਕਿ ਜਿੱਦਾਂ ਕਹਿੰਦੇ ਆ ਕਿ ਦਿਮਾਗ ਦੇ ਨਾਲ ਨਾਲ ਸਿਹਤ ਵੀ ਵਧੀਆ ਹੋਣੀ ਚਾਹੀਦੀ ਆ ਤਾਂ ਹੀ ਆਪਾਂ ਵਧੀਆ ਕੰਮ ਕਰ ਪਾਉਂਦੇ ਹਾਂ ਉਸ ਤਰ੍ਹਾਂ ਹੁਣ ਮੈਂ ਆਪਣਾ ਸਿਹਤ ਵੱਲ ਧਿਆਨ ਪਾਇਆ ਹੋਇਆ ਹੈ ਜਿਸ ਵਿੱਚ ਖੇਡਾਂ ਕਾਫੀ ਵਧੀਆ ਰਹਿੰਦੀਆਂ ਨੇ ਖੇਡਾਂ ਨਾਲ ਮੇਰਾ ਸਰੀਰ ਹੁਣ ਪੂਰਾ ਖੁੱਲ੍ਹ ਜਾ ਰਿਹਾ ਖੁੱਲ੍ਹਾ ਜਿਹਾ ਰਹਿੰਦਾ ਹੈ ਅਤੇ ਮੇਰਾ ਦਿਮਾਗ ਵਧੀਆ ਚਲਦਾ ਹੈ ਸਿਰਫ ਦਿਮਾਗ ਹੀ ਨਹੀਂ ਖੇਡਾਂ ਨਾਲ ਬੰਦੇ ਦੀ ਬੰਦੇ ਦੀ ਆਪਣੀ ਕਾਬਲੀਅਤ ਵੀ ਵੱਧਦੀ ਹੈ ਬੰਦਾ ਵਧੀਆ ਧਿਆਨ ਪਾਉਂਦਾ ਹੈ ਬੰਦਾ ਥੋੜ੍ਹਾ ਸਤਰਕ ਵੀ ਰਹਿੰਦਾ ਹੈ ਖੇਡਣ ਨਾਲ ਸਿਰਫ ਸਾਡਾ ਪੜ੍ਹਾਈ ਵੱਲ ਹੀ ਨਹੀਂ ਹੁਣ ਮੇਰਾ ਸੌਣ ਦਾ ਤੌਰ ਤਰੀਕਾ ਵੀ ਕਾਫੀ ਵਧੀਆ ਹੋ ਚੁੱਕਿਆ ਹੈ ਮੈਂ ਹੁਣ ਨੀਂਦ ਛੇਤੀ ਲੈ ਪਾਉਂਦਾ ਹਾਂ ਅਤੇ ਵਧੀਆ ਲੈ ਪਾਉਂਦਾ ਹਾਂ ਜਿਸ ਕਰਕੇ ਵਧੀਆ ਰਹਿੰਦੀ ਜਿਸ ਕਰਕੇ ਮੈਂ ਸਵੇਰੇ ਵਧੀਆ ਉੱਠਦਾ ਹਾਂ ਅਤੇ ਸਭ ਕੁਝ ਵਧੀਆ ਰਹਿੰਦਾ ਹੈ